ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹਾਂ ਮੈਂ ਰਣਜੀਤ ਸਿੰਘ ਬੋਲ ਰਿਹਾ ਜੀ ਸਰਹਿੰਦ ਤੋਂ ਜੀ ਹਾਂਜੀ ਤੁਹਾਡੇ ਰਿਐਲੇਟਿਵ ਨੇ ਬਰਨਾਲੇ ਤੋਂ ਉਹਨਾਂ ਨੇ ਫ਼ੋਨ ਨੰਬਰ ਦਿੱਤਾ ਸੀ ਤੁਹਾਡਾ ਹਾਂ ਮੈਂ ਇੱਕ ਫੂਡ ਬਲੋਗਰ ਹਾਂ ਜੀ ਅਤੇ ਮੈਂ ਡਿਫਰੈਂਟਸ ਸਟੇਟ ਜਿਹੜੀ ਇੰਡੀਆ ਦੀਆਂ ਉਹਨਾਂ ਬਾਰੇ ਉਹਨਾਂ ਦੇ ਫੂਡ ਯਾਨੀ ਕਿ ਉਹਨਾਂ ਵਾਸਤੇ ਬਲੋਗ ਲਿਖਦਾ ਅਤੇ ਮੇਰਾ ਨੈਕਸਟ ਬਲੋਗ ਹੈਗਾ ਪੰਜਾਬੀ ਫੂਡ ਦੇ ਉੱਪਰ ਅਤੇ ਮੈਨੂੰ ਕੋਈ ਦੱਸੋ ਕਿ ਪੰਜਾਬੀ ਫੂਡ ਕਿਹੜਾ ਫੇਮਸ ਹੈ ਮੈਂ ਉਸ ਬਾਰੇ ਬਲੋਗ ਕਰਨਾ ਅਤੇ ਉਹਦੇ ਬਣਾਉਣ ਦਾ ਤਰੀਕਾ ਕੀ ਹੈ ਅਤੇ ਉਹ ਕਿਸ ਤਰ੍ਹਾਂ ਅਸੀਂ ਉਸਨੂੰ ਦੇਖਦੇ ਹੋ ਕਿ ਵਧੀਆ ਇਸ ਦੇ ਵਿੱਚ ਕਿਸ ਤਰ੍ਹਾਂ ਆ ਉਹ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਅਤੇ ਅੱਛਾ ਜੀ ਠੀਕ ਹੈ ਜੀ ਹਾਂਜੀ ਤੁਸੀਂ ਜਿਹੜਾ ਸਾਗ ਬਾਰੇ ਦੱਸ ਰਹੇ ਸੀ ਨਾ ਉਹਦੇ ਵਿੱਚ ਤੁਸੀਂ ਇੱਕ ਗੱਲ ਦੱਸੀ ਸੀ ਆਲਣ ਇਹ ਆਲਣ ਕੀ ਹੁੰਦਾ ਜੀ ਠੀਕ ਹੈ ਜੀ ਠੀਕ ਜੀ ਅਤੇ ਇਹ ਜਿਹੜਾ ਹਾਂਜੀ ਠੀਕ ਜੀ ਠੀਕ ਹੈ ਜੀ ਅਤੇ ਉਹੀ ਜਿਹੜਾ ਮੱਕੀ ਦਾ ਆਟਾ ਰੋਟੀ ਵੀ ਉਸੇ ਆਟੇ ਦੀ ਬਣ ਜਾਂਦੀ ਹੈ ਜੀ ਹਾਂਜੀ ਠੀਕ ਜੀ ਠੀਕ ਠੀਕ ਹੈ ਜੀ ਅਤੇ ਮੈਨੂੰ ਲੱਗਦਾ ਮੱਕੀ ਰੋਟੀ ਥੋੜ੍ਹੀ ਜਿਹੀ ਉਸ ਤਰ੍ਹਾਂ ਖਾਣ 'ਚ ਥੋੜ੍ਹੀ ਕੋਰਸ ਯਾਨੀ ਕਿ ਥੋੜ੍ਹਾ ਜਿਹਾ ਦਰਦਰੀ ਜਿਹੀ ਹੁੰਦੀ ਹੈ ਦੂਜੇ ਨਾਲੋਂ ਉਸ ਤਰ੍ਹਾਂ ਹੁੰਦੀ ਹੈ ਜੀ ਉਹ ਠੀਕ ਜੀ ਠੀਕ ਹੈ ਜੀ ਅਤੇ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਸੀ ਮੱਖਣ ਅਤੇ ਲੱਸੀ ਲੱਸੀ ਕਿੱਦਾਂ ਕੀ ਰੋਲ ਹੈ ਕਿ ਲੱਸੀ ਕਿਵੇਂ ਟੇਸਟ ਵਧਾਉਂਦੀ ਹੈ ਇਹਦਾ ਠੀਕ ਠੀਕ ਹੈ ਜੀ ਠੀਕ ਹੈ ਯਾਨੀ ਇਹਨਾਂ ਕੰਬੀਨੇਸ਼ਨ ਇੰਝ ਤਿੰਨਾਂ ਚੀਜ਼ਾਂ ਦਾ ਯਾਨੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਅਤੇ ਲੱਸੀ ਇਹ ਕੰਬੀਨੇਸ਼ਨ ਦੇ ਵਿੱਚ ਆ ਠੀਕ ਹੈ ਜੀ ਠੀਕ ਹੈ ਜੀ ਮੈਮ ਬਹੁਤ ਵਧੀਆ ਲੱਗਿਆ ਅਤੇ ਮੈਂ ਨੈਕਸਟ ਬਲੋਗ ਇਹਦੇ ਉੱਪਰ ਹੀ ਆਪਣਾ ਲਿਖੂੰਗਾ ਜੀ ਧੰਨਵਾਦ ਜੀ ਹਾਂਜੀ ਹਾਂਜੀ ਜ਼ਰੂਰ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ